ਸ਼ਹੀਦ ਭਗਤ ਸਿੰਘ ਨਗਰ ਵਿੱਚ ਉਹ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜੋ ਪੰਜਾਬ ਭਰ ਵਿੱਚ ਅਤੇ ਭਾਰਤ ਵਿੱਚ ਪ੍ਰਚਲਿਤ ਹਨ ਜੇਕਰ ਗੱਲ ਕਰੀਏ ਤਾਂ ਦੇਸੀ ਮਹੀਨੇ ਦੇ ਹਿਸਾਬ ਨਾਲ ਹਰੇਕ ਮਹੀਨੇ ਦੇ ਵਿੱਚ ਕੋਈ ਨਾ ਕੋਈ ਤਿਉਹਾਰ ਆ ਹੀ ਜਾਂਦਾ ਹੈ ਅਤੇ ਪੰਜਾਬ ਵਿੱਚ ਚੇਤਰ ਮਹੀਨੇ ਤੋਂ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਸਾਲ ਦੇ ਸ਼ੁਰੂਆਤ ਵਿੱਚ ਹੀ ਆਉਂਦਾ ਹੈ ਲੋਹੜੀ ਦੇ ਵਿੱਚ ਲੋਹੜੀ ਮੰਗੀ ਜਾਂਦੀ ਹੈ ਬੱਚਿਆਂ ਦੁਆਰਾ ਗੁੜ ਰਿਓੜੀਆਂ ਮੂੰਗਫ਼ਲੀ ਇਹ ਸਭ ਕੁਝ ਖਾਇਆ ਜਾਂਦਾ ਹੈ ਅਤੇ ਲੋਹੜੀ ਦੇ ਬਾਅਦ 'ਚੋਂ ਵਿਸਾਖੀ ਦਾ ਤਿਉਹਾਰ ਹੈ ਜੋ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਹੁਤ ਮਸ਼ਹੂਰ ਹੈ ਵਿਸਾਖੀ ਵਾਲੇ ਤਿਉਹਾਰ ਦੇ ਵਿੱਚ ਇਹ ਕਿਉਂਕਿ ਤਿਉਹਾਰ ਕਿਸਾਨਾਂ ਨਾਲ ਸਬੰਧਿਤ ਹੈ ਇਸ ਲਈ ਫਸਲ ਕੱਟਣ ਦੀ ਖੁਸ਼ੀ ਵਿੱਚ ਜੋ ਕਿਸਾਨ ਹਨ ਉਹ ਆਪਣਾ ਸਭ ਕੁਛ ਫਸਲ ਵੇਚ ਕੇ ਆਏ ਹੁੰਦੇ ਹਨ ਅਤੇ ਉਹ ਨਵੇਂ ਕੱਪੜੇ ਪਾ ਕੇ ਖ਼ਰੀਦਦਾਰੀ ਕਰਕੇ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਜਾਂਦੇ ਹਨ ਇੱਥੇ ਹੀ ਗੁਰਦੁਆਰਾ ਟਾਹਲੀ ਸਾਹਿਬ ਹੈ ਜਿੱਥੇ ਕਿ ਵਿਸਾਖੀ ਦੇ ਦੌਰਾਨ ਬਹੁਤ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਸੇਵਾ ਕਰਦੇ ਹਨ ਇਸ ਤੋਂ ਬਾਅਦ ਸਾਉਣ ਮਹੀਨੇ ਦੀਆਂ ਤੀਆਂ ਵੀ ਕਈ ਪਿੰਡਾਂ ਵਿੱਚ ਲੱਗਦੀਆਂ ਹਨ ਉੱਥੇ ਕੁੜੀਆਂ ਇਕੱਠੀਆਂ ਹੋ ਕੇ ਪੀਂਘਾਂ ਪਾਉਂਦੀਆਂ ਹਨ ਪੀਂਘਾਂ ਪਾਉਂਣ ਦੇ ਨਾਲ ਨਾਲ ਪੁਰਾਣੇ ਲੋਕ ਗੀਤ ਗਾਏ ਜਾਂਦੇ ਹਨ ਲੋਕ ਗੀਤਾਂ ਤੋਂ ਇਲਾਵਾ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਸਾਉਣ ਦੇ ਮਹੀਨੇ ਵਿੱਚ ਖੀਰ ਅਤੇ ਪੂੜੇ ਖਾਣ ਵਿੱਚ ਬਹੁਤ ਮਸ਼ਹੂਰ ਮੰਨੇ ਜਾਂਦੇ ਹਨ ਅਤੇ ਹਰੇਕ ਕੋਈ ਇਸ ਨੂੰ ਖਾ ਕੇ ਬਹੁਤ ਅਨੰਦ ਮਹਿਸੂਸ ਕਰਦਾ ਹੈ ਇਸ ਤੋਂ ਬਾਅਦ ਹੀ ਦੀਵਾਲੀ ਦਾ ਤਿਉਹਾਰ ਹੈ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਦੁਸਹਿਰੇ ਦਾ ਤਿਉਹਾਰ ਹੈ ਸ਼ਹੀਦ ਭਗਤ ਸਿੰਘ ਨਗਰ ਵਿੱਚ ਦੁਸਹਿਰੇ ਦੇ ਦੌਰਾਨ ਆਈ ਟੀ ਆਈ ਗਰਾਊਂਡ ਦੇ ਵਿੱਚ ਬਹੁਤ ਬੜਾ ਪੁਤਲਾ ਰਾਵਣ ਦਾ ਜਲਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੀਵਾਲੀ ਆਉਂਦੀ ਹੈ ਇਹਨਾਂ ਦਿਨਾਂ ਦੇ ਦਰਮਿਆਨ ਹੀ ਰਾਮ ਲੀਲਾ ਵੀ ਕਈ ਪਿੰਡਾਂ ਵਿੱਚ ਹੁੰਦੀ ਹੈ ਅਤੇ ਲੋਕ ਇਸ ਦਾ ਬਹੁਤ ਅਨੰਦ ਮਾਣਦੇ ਹਨ ਦੀਵਾਲੀ ਆਉਂਦਿਆ ਸਾਰ ਹੀ ਬਜ਼ਾਰਾਂ ਵਿੱਚ ਅਤੇ ਬਾਕੀ ਪਿੰਡਾਂ ਵਿੱਚ ਵੀ ਬਹੁਤ ਚਹਿਲ ਪਹਿਲ ਵੱਧ ਜਾਂਦੀ ਹੈ ਲੋਕ ਆਪਣੇ ਘਰਾਂ ਨੂੰ ਰੰਗ ਕਰਵਾਉਂਦੇ ਹਨ ਅਤੇ ਸਾਫ਼ ਸਫ਼ਾਈਆਂ ਕਰਦੇ ਹਨ ਨਵਾਂਸ਼ਹਿਰ ਮਾਰਕਿਟ ਦੇ ਵਿੱਚ ਬਹੁਤ ਸਾਰੀਆਂ ਖ਼ਰੀਦਦਾਰੀ ਦੀਆਂ ਚੀਜ਼ਾਂ ਆ ਜਾਂਦੀਆਂ ਹਨ ਅਤੇ ਲੋਕ ਇਹਨਾਂ ਨੂੰ ਬੜੇ ਚਾਅ ਨਾਲ ਖ਼ਰੀਦਦੇ ਹਨ ਇਸ ਤੋਂ ਇਲਾਵਾ ਬੱਚਿਆਂ ਲਈ ਪਟਾਕਿਆਂ ਦਾ ਚਾਲ ਚੱਲਣ ਵੀ ਬਹੁਤ ਹੋ ਗਿਆ ਹੈ ਅਤੇ ਦੀਵਾਲੀ ਤੋਂ ਬਾਅਦ ਹੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਵੀ ਆਉਂਦਾ ਹੈ ਉਹ ਵੀ ਹਰ ਇੱਕ ਗੁਰਦੁਆਰੇ ਵਿੱਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ ਅਤੇ ਸ਼ਰਧਾਲੂ ਉਸ ਉਸ ਦਿਨ ਪਾਠ ਕਰਦੇ ਹਨ ਅਤੇ ਪਾਠ ਤੋਂ ਬਾਅਦ ਕਈ ਜਗ੍ਹਾ ਲੰਗਰ ਵੀ ਲਗਾਏ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਹੋਲੀ ਦਾ ਤਿਉਹਾਰ ਵੀ ਹੈ ਜੋ ਵੀ ਜੋ ਕਿ ਕਈ ਭਾਈਚਾਰਿਆਂ ਦੁਆਰਾ ਇੱਥੇ ਮਨਾਇਆ ਜਾਂਦਾ ਹੈ ਸਾਰੇ ਇੱਕ ਦੂਜੇ ਨੂੰ ਬੜੇ ਪਿਆਰ ਨਾਲ ਰੰਗ ਲਗਾਉਂਦੇ ਹਨ ਅਤੇ ਮਸਤੀ ਦੇ ਵਿੱਚ ਨੱਚਦੇ ਫਿਰਦੇ ਹਨ ਕਈ ਜਗ੍ਹਾ ਬੱਚੇ ਪਤੰਗਬਾਜ਼ੀ ਵੀ ਕਰਦੇ ਹਨ ਅਤੇ ਪਤੰਗ ਕੱਟਣ ਦਾ ਮੁਕਾਬਲਾ ਵੀ ਕਰਾਉਂਦੇ ਹਨ